ਮੈਂ ਤੁਹਾਡੇ ਰੈਸਟੋਰੈਂਟ ਹੰਗਰੀ ਪੁਆਇੰਟ ਤੋਂ ਬਰਗਰ ਆਰਡਰ ਕੀਤਾ ਸੀ ਜੋ ਕਿ ਖਾਣ ਦੀ ਹਾਲਤ ਵਿਚ ਨਹੀਂ ਹੈ ਉਹ ਬਾਸਾ ਹੈ ਅਤੇ ਉਸ ਵਿੱਚੋਂ ਬਦਬੂ ਆ ਰਹੀ ਹੈ ਮੈਂ ਤੁਹਾਨੂੰ ਬੇਨਤੀ ਕਰਦੀ ਹਾਂ ਕਿ ਮੇਰੇ ਭੋਜਨ ਦੀ ਬਦਲੀ ਕੀਤੀ ਜਾਵੇ ਜਾਂ ਤਾਂ ਮੈਨੂੰ ਮੇਰੇ ਪੈਸੇ ਰਿਫੰਡ ਕੀਤੇ ਜਾਣ